ਹਰ ਗਜ਼ਲ ਦਾ ਅਸਲ ਹਿੰਦੀ ਵਿੱਚ ਹੈ ਅਤੇ ਨਾਲ ਹੀ ਉਸਦਾ ਉਤਾਰਾ ਗੁਰਮੁਖੀ ਵਿੱਚ ਕੀਤਾ ਗਿਆ ਹੈ ਅਸਲ ਵਿੱਚ ਇਹ ਹਨ ਕਿ ਹਿੰਦੀ ਗਜ਼ਲਾਂ ਜਿਹਨਾਂ ਨੂੰ ਸਿਰਫ ਗੁਰਮੁਖੀ ਜਾਨਣ ਵਾਲਿਆਂ ਲਈ ਸੌਖਾ ਕੀਤਾ ਗਿਆ ਹੈ ਬਹੁਤੀਆਂ ਗਜ਼ਲਾਂ ਰੋਮਾਂਟਿਕ ਹਨ ਜਿਹਨਾਂ ਦੀ ਭਾਸ਼ਾ ਸਾਧ ਮੁਰਾਦੀ ਹੈ ਧੰਨਵਾਦ